ਜਦੋਂ ਲੋਕਾਂ ਨੂੰ ਨਿਆਂ ਚਾਹੀਦਾ ਹੁੰਦਾ ਹੈ ਤਾਂ ਉਹ ਧਰਨਿਆਂ 'ਤੇ ਬੈਠ ਜਾਂਦੇ ਹਨ ਤਾਂ ਮੀਡੀਆ ਸਭ ਕੁਝ ਰਿਕੋਡ ਕਰਨ ਲਈ ਉੱਥੇ ਮਿੰਟਾਂ 'ਚ ਹੀ ਪਹੁੰਚ ਜਾਂਦੀ ਹੈ ਮੀਡੀਆ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਲੋਕਾਂ ਦੀ ਮਦਦ ਕਰਦੀ ਹੈ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਦੀ ਹੈ ਸਰਕਾਰ ਲੋ ਕਾਂ ਦੀ ਆਵਾਜ਼ ਮੀਡੀਆ ਰਾਹੀਂ ਸੁਣਦੀ ਹੈ ਮੀਡੀਆ ਕਈ ਵਾਰੀ ਤਾਂ ਲੋਕਾਂ ਦਾ ਸਾਥ ਦਿੰਦੀ ਹੈ ਜੇ ਕਿਸੇ ਨਾਲ ਕਿਤੇ ਵੀ ਗਲਤ ਵਿਹਾਰ ਹੁੰਦਾ ਹੈ ਜਿਵੇਂ ਕਿ ਵੱਡੇ ਲੋਕ ਗਰੀਬਾਂ ਦਾ ਹੱਕ ਮਾਰ ਲੈਂਦੇ ਹਨ ਜਾਂ ਛੋਟੇ ਲੋਕਾਂ ਦਾ ਉਹਨਾਂ ਦੀ ਕਮਾਈ ਅਤੇ ਪੈਸੇ ਹੱਕ ਦੇ ਪੈਸੇ ਉਹਨਾਂ ਨੂੰ ਨਹੀਂ ਦਿੰਦੇ ਤਾਂ ਮੀਡੀਆ ਉਹਨਾਂ ਦੇ ਪੈਸੇ ਉਹਨਾਂ ਦੇ ਹੱਕ ਦਵਾਉਣ ਵਿੱਚ ਉਹਨਾਂ ਦੀ ਕਾਫੀ ਸਹਾਇਤਾ ਕਰਦੀ ਹੈ ਮੀਡੀਆ ਹੀ ਹੈ ਜੋ ਉਹਨਾਂ ਦੇ ਮਦਦ ਕਰਦੀ ਹੈ ਉਹਨਾਂ ਦੇ ਹੱਕ ਦਵਾਉਣ ਵਿੱਚ ਉਹਨਾਂ ਦੀ ਕਮਾਈ ਵਿੱਚ ਉਹਨਾਂ ਦੀ ਹੱਕ ਆਇਆ